ਹਾਂਜੀ ਸਤਿ ਸ਼੍ਰੀ ਅਕਾਲ ਜੀ

ਹਾਂਜੀ ਕੋਈ ਨਹੀਂ ਆਪਾਂ ਬੱਚੇ ਜੇ ਭੱਜ ਜਾਂਦੇ ਆ ਆਪਾਂ ਸਕੂਲ ਦੀਆਂ ਕੰਧਾਂ ਵਗੈਰਾ ਉੱਚੀ ਕਰਾਵਾਂਗੇ ਤਾਰਾਂ ਵਗੈਰਾ ਲਾਵਾਂਗੇ ਮੈਂ ਪ੍ਰਿੰਸੀਪਲ ਸਰ ਨਾਲ ਗੱਲ ਜਰੂਰ ਕਰਾਂਗੀ ਆਪਣੇ ਕਈ ਟੀਚਰ ਹੈਗੇ ਗੱਲਾਂ 'ਤੇ ਗੌਰ ਨਹੀਂ ਕਰਦੇ ਕੋਈ ਨਹੀਂ ਮੈਂ ਪ੍ਰਿੰਸੀਪਲ ਸਰ ਨੂੰ ਕਹਾਂਗੀ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਮੈਂ ਵੀ ਦੇਖਿਆ ਨੇ ਆਪਣੀ ਕਲਾਸ ਦੇ ਕਈ ਡੈਕਸ ਬਹੁਤ ਜਿਆਦਾ ਟੁੱਟੇ ਹੋਏ ਨੇ ਖ਼ਰਾਬ ਨੇ ਅਤੇ ਪ੍ਰਿੰਸੀਪਲ ਸਰ ਨੂੰ ਕਿਹਾ ਸੀ ਪਰ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਪ੍ਰੰਤੂ ਕਈ ਟੀਚਰ ਸਰ ਨਾਲ ਗੱਲ ਨਹੀਂ ਕਰਦੇ ਆਪਾਂ ਨੂੰ ਸਾਰੇ ਟੀਚਰਾਂ ਨੂੰ ਕਹਿਣਾ ਚਾਹੀਦਾ ਸਾਰੇ ਟੀਚਰ ਰਲ ਕੇ ਕਹਾਂਗੇ ਪ੍ਰਿੰਸੀਪਲ ਸਰ ਗੱਲ ਸੁਣਨਗੇ ਇੱਦਾਂ ਤਾਂ ਉਹਨਾਂ ਨੇ ਸੁਣਨੀ ਨਹੀਂ

ਜ਼ਰੂਰੀ ਜੀ ਜ਼ਰੂਰ ਕਰਾਂਗੇ ਆਪਣੇ ਕਈ ਟੀਚਰ ਪੜ੍ਹਾਉਂਦੇ ਵੀ ਬਹੁਤ ਘੱਟ ਨੇ ਆਪਾਂ ਸਰ ਨੂੰ ਕਹਾਂਗੇ ਵੀ ਇਹ ਗੱਲ 'ਤੇ ਗੌਰ ਕਰਿਓ ਕੁਝ ਪਾਣੀ ਦੀ ਸਮੱਸਿਆਵਾਂ ਨੇ ਪਾਣੀ ਸਾਫ ਨਹੀਂ ਆ ਰਿਹਾ ਆਰ ਓ ਜੀ ਆਰ ਓ ਦੀ ਵੀ ਬਹੁਤ ਜ਼ਰੂਰਤ ਹੈ ਕੋਈ ਨਹੀਂ ਇਹ ਗੱਲ ਆਪਾਂ ਅਨਾਊਂਸਮੈਂਟ ਅਸੈਂਬਲੀ 'ਚ ਹੀ ਕਰਾਂਗੀ ਕਿ ਸਾਰੇ ਬੱਚੇ ਅਸੈਂਬਲੀ 'ਚ ਆਉਣ ਕੋਈ ਨਹੀਂ ਆਪਾਂ ਇੱਕ ਅਸੈਂਬਲੀ ਰੱਖਾਂਗੇ ਮੇਨ ਉੱਥੇ ਗੱਲ ਕਰਾਂਗੇ ਕਿ ਬੱਚੇ ਅਸੈਂਬਲੀ 'ਚ ਜ਼ਰੂਰ ਹਨ ਅਤੇ ਟੀਚਰ ਦੀ ਡਿਊਟੀ ਆਪ ਲੱਗਾਵਾਂਗੇ ਕਿ ਕਲਾਸ ਦੇ ਹਰ ਇੱਕ ਬੱਚੇ ਨੂੰ ਅਸੈਂਬਲੀ 'ਚ ਲਿਆਂਦਾ ਜਾਵੇ ਹੋਰ ਕੋਈ ਸਮੱਸਿਆ ਹੋਵੇ ਤਾ ਹਾਂਜੀ ਜ਼ਰੂਰ ਜੀ ਜ਼ਰੂਰ ਆਪਾਂ ਇਹ ਇਹ ਗੱਲ ਦਾ ਹੱਲ ਕਰਾਵਾਂਗੇ ਪ੍ਰਿੰਸੀਪਲ ਸਰ ਨੂੰ ਮੈਂ ਜ਼ਰੂਰ ਕਹਾਂਗੀ ਮੈਂ ਹੁਣੇ ਕਾਲ ਕਰਕੇ ਕਹਾਂਗੀ ਕਿ ਇਹ ਸਮੱਸਿਆ ਦਾ ਹੱਲ ਕਰਾਉਣ ਦੱਸੋ ਜੀ ਜ਼ਰੂਰ ਜੀ ਜ਼ਰੂਰ ਮੈਂ ਕਹਾਂਗੀ ਸਰ ਨੂੰ ਵੀ ਸਮੱਸਿਆ ਦਾ ਹੱਲ ਜ਼ਰੂਰ ਕਰਾਉਣ ਠੀਕ ਆ ਓਕੇ ਬਸ ਵਧੀਆ ਤੁਸੀਂ ਦੱਸੋ ਓਕੇ ਵੈਲਕਮ